ਮੈਂ ਮਾਤਾ ਨੈਣਾ ਦੇਵੀ ਯਾਤਰਾ 'ਤੇ ਗਿਆ ਉੱਥੇ ਦਾ ਅਨੁਭਵ ਬਹੁਤ ਵਧੀਆ ਸੀ ਉੱਥੇ ਦਾ ਮਾਹੌਲ ਉੱਥੇ ਦਾ ਮੌਸਮ ਬਹੁਤ ਵਧੀਆ ਸੀ ਉੱਥੇ ਦਾ ਵਿਊ ਜਾਂ ਕਹਿ ਲਉ ਵੀ ਪ੍ਰਕਿਰਤੀਆਂ ਦੇਖਣ ਵਾਲੀਆਂ ਸੀ ਠੀਕ ਆ ਜਦੋਂ ਜਦੋਂ ਅਸੀਂ ਸ਼ਾਮ ਨੂੰ ਗਏ ਤਾਂ ਉੱਥੇ ਸੂਰਜ ਡੁੱਬ ਰਿਹਾ ਸੀ ਤਾਂ ਉਸ ਡੁੱਬਣ ਦਾ ਦ੍ਰਿਸ਼ ਬਹੁਤ ਵਧੀਆ ਸੀ ਅਤੇ ਜਦੋਂ ਜੀ ਸਵੇਰੇ ਸਵੇਰੇ ਉੱਠੇ ਮੱਥਾ ਟੇਕਣ ਗਏ ਤਾਂ ਉੱਥੇ ਦੇ ਜਿਹੜਾ ਸੂਰਜ ਜਦੋਂ ਉੱਗਿਆ ਠੀਕ ਆ ਤਾਂ ਉਹਦਾ ਦ੍ਰਿਸ਼ ਵੀ ਬਹੁਤ ਵਧੀਆ ਸੀ ਸੋ ਮੈਨੂੰ ਬਹੁਤ ਆਨੰਦ ਆਇਆ